ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਲ ਹੈ ਕਿ ਤੁਸੀਂ ਕਿਸੇ ਨੂੰ ਪੇਂਟਿੰਗ ਜਾਂ ਹੱਥ ਦੇ ਬਣੇ ਕਾਰਡਾਂ ਦਾ ਤੋਹਫਾ ਦਿੱਤਾ ਹੈ ਜੇ ਅਜਿਹਾ ਹੈ ਤਾਂ ਹੋਰ ਦੱਸੋ ਹੱਥ ਨਾਲ ਬਣੀਆਂ ਚੀਜ਼ਾਂ ਦਾ ਜ਼ਿਆਦਾ ਭਵਾਤਮ ਮੁੱਲ ਕਿਉਂ ਹੁੰਦਾ ਹੈ ਇਸ ਦਾ ਕਾਰਨ ਇਹ ਹੈ ਜੋ ਆਪਾਂ ਦੇਖਦੇ ਹਾਂ ਜਾਂ ਬਜ਼ੁਰਗਾਂ ਤੋਂ ਸੁਣਦੇ ਹਾਂ ਕਿ ਪਹਿਲਾਂ ਜੋ ਚਿੱਠੀਆਂ ਜਾਂ ਹੋਰ ਆਪਾਂ ਭੇਜਦੇ ਸੀ ਤਾਂ ਉਹ ਤਾਂ ਭੇਜੀਆਂ ਜਾਂਦੀਆਂ ਸੀ ਜੋ ਦਿਲੋਂ ਆਪਣਾ ਹੁੰਦਾ ਹੁੰਦਾ ਸੀਗਾ ਬੰਦੇ ਦਾ ਤਾਂ ਉਹਨੂੰ ਭੇਜੀਆ ਜਾਂਦੀਆਂ ਅਤੇ ਜੋ ਆਪਾਂ ਕਿਸੇ ਦੇ ਆਪਾਂ ਦੇਖਦੇ ਹਾਂ ਜਿਵੇਂ ਕੋਈ ਕਿਸੇ ਸਿੰਗਰ ਨੂੰ ਜਾਂ ਕਿਸੇ ਹੋਰ ਨੂੰ ਜਾ ਕਿਸੇ ਯਾਰ ਮਿੱਤਰ ਨੂੰ ਆਪਾਂ ਪੇਂਟਿੰਗ ਉਹਨਾਂ ਦੀ ਫੋਟੋ ਜਾਂ ਹੋਰ ਹੱਥ ਦੀ ਕਾਰਾਗਰੀ ਨਾਲ ਬਣਾ ਕੇ ਭੇਜਦੇ ਹਾਂ ਅਤੇ ਉਹ ਦ ਖਿੱਚ ਦਾ ਕੇਂਦਰ ਬਣਦੇ ਨੇ ਕਿਉਂਕਿ ਉਹ ਬੰਦੇ ਦੀਆਂ ਭਾਵਨਾਵਾਂ ਆਪਣੀਆਂ ਭਾਵਨਾਵਾਂ ਲੋਕਾਂ ਦੇ ਅੱਗੇ ਹੱਥ 'ਤੇ ਹੱਥ ਦੀ ਕਰਾਮਾਤ ਦੇ ਨਾਲ ਦਰਸਾਉਂਦਾ ਹੈ ਜਿਹਦਾ ਮੁੱਲ ਲੈਣ ਵਾਲੇ ਦਾ ਅਤੇ ਉਹਨੂੰ ਦੇਣ ਵਾਲੇ ਦਾ ਕੋਈ ਉਹਦਾ ਮੁੱਲ ਨਹੀਂ ਹੈ ਕਿਉਂਕਿ ਹਰ ਉਹ ਦਿਲ ਆਪਦੀਆਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਹੀ ਦਿੱਤਾ ਜਾਂਦਾ ਜੋ ਅੱਜ ਦੇ ਸਮੇਂ ਲਈ ਬਹੁਤ ਲਾਭਦਾਇਕ